ਅਸੀਂ ਸਭ ਤੋਂ ਪਹਿਲਾਂ ਪਿੰਡ ਵਿੱਚ ਗੱਲ ਕਰੀਏ ਤਾਂ ਪਿੰਡਾਂ ਵਿੱਚ ਬਹੁਤ ਘੱਟ ਫੈਸਿਲਟੀਸ ਹੁੰਦੀਆਂ ਨੇ ਤਾਂ ਇਸ ਲਈ ਅਸੀਂ ਸੋਚਿਆ ਕਿ ਕੋਈ ਨਾ ਕੋਈ ਕੰਮ ਸ਼ੁਰੂ ਕੀਤਾ ਜਾਵੇ ਇਸ ਲਈ ਅਸੀਂ ਆਪਣੇ ਭਾਈਚਾਰੇ ਵਿੱਚ ਰਲ ਕੇ ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਖੋਲਣ ਬਾਰੇ ਸੋਚਿਆ ਅਤੇ ਇੱਕ ਨਾਲ ਹੋਰ ਦੁਕਾਨ ਲਈ ਜਿਹਦੇ ਵਿੱਚ ਕਿ ਅਸੀਂ ਗੱਦੇ ਦਰੀਆਂ ਵਗੈਰਾ ਰੱਖ ਲਈਆਂ ਅਤੇ ਕਰਿਆਨੇ ਦੀ ਦੁਕਾਨ ਵਿੱਚ ਵੀ ਅਸੀਂ ਬਹੁਤ ਸਾਰਾ ਸਮਾਨ ਰੱਖ ਲਿਆ ਤਾਂ ਲੋਕਾਂ ਪਹਿਲਾਂ ਲੋਕਾਂ ਨੂੰ ਪਿੰਡ ਤੋਂ ਬਾਹਰ ਜਾਣਾ ਪੈਂਦਾ ਸੀ ਸਮਾਨ ਲੈਣ ਲਈ ਫਿਰ ਬਾਅਦ 'ਚੋਂ ਸਾਡੀ ਦੁਕਾਨ ਇੰਨੀ ਚੱਲੀ ਕਿ ਲੋਕ ਸਾਰੇ ਪਿੰਡ ਦੇ ਲੋਕ ਨੇੜਿਓਂ ਹੀ ਸਾਰਾ ਕੁਛ ਲੈਣਾ ਪਸੰਦ ਕਰਨ ਲੱਗ ਗਏ ਅਤੇ ਉਨ੍ਹਾਂ ਨੇ ਸਾਰਾ ਸਮਾਨ ਪਿੰਡ ਦੀ ਦੁਕਾਨ ਤੋਂ ਹੀ ਲਿਆ ਜਿਹਦੇ ਨਾਲ ਕਿ ਸਾਨੂੰ ਬਹੁਤ ਪ੍ਰੋਫਿੱਟ ਹੋਇਆ ਅਤੇ ਅਸੀਂ ਇਹਦੇ ਨਾਲ ਵੱਧ ਤੋਂ ਵੱਧ ਪੈਸਾ ਕਮਾਇਆ ਜਿਹਦੇ ਨਾਲ ਕਿ ਅਸੀਂ ਫਿਊਚਰ ਲਈ ਬਹੁਤ ਕੁਛ ਸੇਵ ਕਰ ਸਕਦੇ ਸੀ ਅਤੇ ਪਿੰਡਾਂ ਦੀਆਂ ਔਰਤਾਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਦੁਕਾਨਾਂ 'ਤੇ ਬੈਠ ਜਾਂਦੀਆਂ ਨੇ ਉਹ ਬਹੁਤ ਹਾਰਡ ਵਰਕ ਕਰਦੀਆਂ ਨੇ ਹਾਲਾਂਕਿ ਸ਼ਹਿਰਾਂ ਵਾਲੇ ਲੋਕ ਇੰਨਾ ਹਾਰਡ ਵਰਕ ਨਹੀਂ ਕਰਦੇ ਜਿੰਨਾ ਕਿ ਪਿੰਡਾਂ ਵਾਲੇ ਕਰਦੇ ਹੈ ਜਿਹਦੇ ਨਾਲ ਕਿ ਪਿੰਡ ਵਾਲੇ ਲੋਕ ਜ਼ਿਆਦਾ ਸਫ਼ਲ ਹੁੰਦੇ ਹੈ ਅਤੇ ਉਹ ਜ਼ਿਆਦਾ ਪੈਸਾ ਕਮਾਉਂਦੇ ਹੈ ਅਤੇ ਉਨ੍ਹਾਂ ਦਾ ਜਿਹੜਾ ਫਿਊਚਰ ਹੈ ਉਹ ਵੀ ਸਕਿਓਰ ਹੋ ਜਾਂਦਾ ਹੈ ਅਤੇ ਅਸੀਂ ਵੀ ਇੱਕ ਵਾਰੀ ਦੁਕਾਨ ਖੋਲ੍ਹੀ ਜਿਹਦੇ ਵਿੱਚ ਕਿ ਅਸੀਂ ਬਹੁਤ ਸਾਰਾ ਸਮਾਨ ਰੱਖਿਆ ਜਿਹਦੇ ਨਾਲ ਸਾਨੂੰ ਬਹੁਤ ਪ੍ਰੋਫਿਟ ਹੋਇਆ ਅਤੇ ਅਸੀਂ ਸਾਡੀ ਉਹ ਦੁਕਾਨ ਹਜੇ ਤੱਕ ਵੀ ਚਲ ਰਹੀ ਹੈ ਜਿਹਦੇ ਤੋਂ ਸਾਨੂੰ ਦਿਨੋਂ ਦਿਨ ਵੱਧ ਤੋਂ ਵੱਧ ਪ੍ਰੋਫਿਟ ਹੁੰਦਾ ਪਿਆ ਅਤੇ ਇਸ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਅੱਗੇ ਜਨਰੇਸ਼ਨ ਵੀ ਇਸ ਤੋਂ ਵਧੀਆ ਪੈਸੇ ਕਮਾ ਸਕਦੀ ਹੈ ਜਿਹਦੇ ਨਾਲ ਕਿ ਉਨ੍ਹਾਂ ਦਾ ਵੀ ਫਿਊਚਰ ਸੇਫ ਹੋ ਸਕਦਾ ਹੈ